ਭਾਰਤ ਵਿੱਚ ਮਨੋਰੰਜਨ ਦੇ ਬਹੁਤ ਸਾਰੇ ਸਾਧਨ ਹਨ ਭਾਰਤ ਵਿੱਚ ਹਰੇਕ ਸਟੇਟ ਦੇ ਆਪਣੇ ਅਲੱਗ ਲੋਕਨਾਚ ਹਨ ਜਿਵੇਂ ਪੰਜਾਬ ਵਿੱਚ ਭੰਗੜਾ ਅਤੇ ਗਿੱਧਾ ਬਹੁਤ ਜ਼ਿਆਦਾ ਮਸ਼ਹੂਰ ਹੈ ਅਤੇ ਇੱਥੇ ਖੇਡਾਂ ਦੇ ਵੀ ਮਨੋਰੰਜਨ ਹਨ ਅਤੇ ਸਿਨੇਮਾ ਉਦਯੋਗ ਬਹੁਤ ਜ਼ਿਆਦਾ ਪ੍ਰਫੁੱਲਤ ਹੈ ਅਤੇ ਹਰੇਕ ਸ ਫਿਲਮਾਂ ਬਹੁਤ ਪਸੰਦ ਕਰਦੇ ਹਨ ਲੋਕ ਅਤੇ ਖੇਡਾਂ ਦੇ ਮਨੋਰੰਜਨ ਵਿੱਚ ਵੀ ਬਹੁਤ ਜ਼ਿਆਦਾ ਪਸੰਦ ਕਰਦੇ ਹਨ